ਜਲੰਧਰ ਜ਼ਿਲ੍ਹੇ ਵਿੱਚ ਕਈਆਂ ਮੁੱਖ ਫਸਲਾਂ ਉਡਾ ਉਗਾਈਆਂ ਜਾਂਦੀਆਂ ਹਨ ਜਲੰਧਰ ਜ਼ਿਲ੍ਹੇ ਵਿੱਚ ਚਾਵਲ ਗੰਨਾ ਕਨਕ ਕਪਾਹ ਨਾਚ ਡਾਲਨਾ ਫਲ ਟਮਾਕੂ ਆਦਿ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ ਆਟਾ ਅਤੇ ਪਕਵਾਨਾਂ ਵਿੱਚ ਘੇ ਦੀ ਵਰਤੋਂ ਕੀਤੀ ਜਾਂਦੀ ਆਸਥਾ ਵਿੱਚ ਜਿਵੇਂ ਚਾਵਲ ਵੀ ਹਰ ਜ਼ਿਲ੍ਹੇ ਵਿੱਚ ਚਲਦੇ ਹਨ ਗੰਨੇ ਗੰਨੇ ਦੇ ਚਾਵਲ ਦੇ ਨਾਲ ਕਈ ਤਰ੍ਹਾਂ ਦੀ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਗੰਨੇ ਆ ਚੀਨੀ ਤੋਂ ਬਣਦਾ ਹੈ ਕਪਾਹ ਅੰਨ ਹੁੰਦਾ ਹੈ ਅਨਾਜ ਇੱਕ ਕਣਕ ਦੇ ਦਾਣੇ ਵਾਲੇ ਹੁੰਦਾ ਹੈ ਦਾਲਾਂ ਫਲ ਸਬਜ਼ੀ ਆਦਿ ਬਣਦੀਆਂ ਹਨ ਕਿਹੜੀਆਂ ਫਸਲਾਂ ਇੱਕ 'ਚ ਸਭ ਤੋਂ ਮੰਗ ਕੀਤੀ ਜਾਂਦੀ ਹੈ ਚਾਵਲ ਨੂੰ ਵੀ ਪਕਾ ਕੇ ਬਣਾਇਆ ਜਾਂਦਾ ਇਹ ਰਸ ਰਸ ਗੰਨੇ ਦਾ ਰਸ ਬਣਾਇਆ ਜਾਂਦਾ ਹੈ ਅਤੇ ਕਣਕ ਨੂੰ ਪਿਸਾ ਕੇ ਉਸਨੂੰ ਧੋ ਕੇ ਪੀਸ ਕੇ ਅਤੇ ਆ ਪੀਸਿਆ ਜਾਂਦਾ ਹੈ ਅਤੇ ਉਸਦੀ ਆਟਾ ਗੁੰਨ ਕੇ ਰੋਟੀ ਬਣਾਈ ਜਾਂਦੀ ਹੈ ਅਨਾਜ ਦਾਣੇ ਵਾਂਗੂੰ ਦਾਲਾਂ ਕਈ ਕਿਸਮਾਂ ਦੀ ਤਰ੍ਹਾਂ ਹੁੰਦੀ ਹੈ ਤੰਬਾਕੂ ਇੱਕ ਸਬਜ਼ੀਆਂ ਨੂੰ ਵੀ ਚੰਗੀ ਤਰਾਂ ਪਕਾ ਕੇ ਬਣਾਇਆ ਜਾਂਦਾ ਹੈ ਸਭ ਤੋਂ ਮੰਗ ਕੀਤੀ ਜਾਂਦੀ ਹੈ ਸਭ ਤੋਂ ਜ਼ਿਆਦਾ ਚਾਵਲ ਗੰਨੇ ਦੀ ਅਨਾਜ ਦੀ ਵਰਤੋਂ ਕੀਤੀ ਜਾਂਦੀ ਕਈ ਕਿਸਮਾਂ ਦੀਆਂ ਦਾਲਾਂ ਦਾਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਐ ਬੀਜਣ ਤੋਂ ਲੈ ਕੇ ਮੰਡੀ ਵਿੱਚ ਅਨਾਜ ਵੇਚਣ ਤੱਕ ਦੀ ਪ੍ਰਕਿਰਿਆ ਦੱਸੋ ਇਹ ਅਸੀਂ ਚਾਵਲ ਨੂੰ ਵੀ ਬੀਜਦੇ ਹਾਂ ਗੰਨੇ ਦੀ ਵੀ ਵਾ ਕੀਤੀ ਜਾਂਦੀ ਹੈ ਅਨਾਜ ਕਣਕ ਇਹਨਾਂ ਸਾਰਿਆਂ ਦੀ ਫਲ ਸਬਜ਼ੀਆਂ ਆਦਿ ਨੂੰ ਬੀਜਿਆ ਜਾਂਦਾ ਹੈ ਅਤੇ ਫਿਰ ਬੀਜ ਕੇ ਜਦੋਂ ਇਹ ਚੰਗੀ ਤਰ੍ਹਾਂ ਪੱਕ ਜਾਂਦੇ ਹਨ ਤਾਂ ਇਹਨਾਂ ਨੂੰ ਮੰਡੀ ਵਿੱਚ ਵੇਚਿਆ ਜਾਂਦਾ ਹੈ ਕੇਰੀਆਂ ਫਸਲਾਂ ਲਈ ਮਨਪਸੰਦ ਦਾ ਮੌਸਮ ਕੀ ਹਨ ਕੋਲੀਫਲਾਵਰ ਦੀ ਜਿਵੇਂ ਸਰਦੀਆਂ ਵਿੱਚ ਸਬਜ਼ੀਆਂ ਮਤਲਬ ਮੂਲੀ ਗਾਜਰ ਆਦਿ ਹੁੰਦੀ ਹੈ ਅਤੇ ਜਿਵੇਂ ਸਾਗ ਹੋ ਗਿਆ ਉਹ ਸਰਦੀਆਂ 'ਚ ਕੀਤੀ ਜਾਂਦੀ ਹੈ ਅਤੇ ਅਪ੍ਰੈਲ ਮਈ ਵਿੱਚ ਮੈਂਗੋ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਅੰਬ ਦਾ ਮੌਸਮ ਆ ਜਾਂਦਾ ਅਤੇ ਟਮਾਟਰ ਤਾਂ ਸਦਾਬਹਾਰ ਹੀ ਹੁੰਦਾ ਹੈ